ਹਾਂਜੀ ਤੁਸੀਂ ਕੌਨ ਅੱਛਾ ਅੱਛਿਆ ਠੀਕ ਐ ਹਾਂਜੀ ਮੈਡਮ ਸਸਰੀ ਕਾਲ ਠੀਕ ਐ ਵਧੀਆ

ਸਿਹਤਾਂ ਬਸ ਚਲੀ ਆਉਂਦਾ ਰੋਜ ਦਵਾਈ ਖਾ ਲਈ ਤੇ ਤੁਰਿਆਂ ਜਾਂਦਾ

ਕਿੰਨੇ ਸਾਲ ਦਾ ਹੋ ਗਿਆ ਅੱਛਿਆ ਠੀਕ ਐ ਕੀ ਪਹਿਲਾਂ ਪਲੇਅ ਵੇਅ 'ਚ ਲੱਗਿਆ ਵਾ ਅੱਛਾ ਅੱਛਿਆ ਹਾਂ ਆਂ ਮੇਰਾ ਬੇਟਾ ਵੀ ਹੁਨ ਦਸ ਸਾਲ ਦਾ ਹੋ ਗਿਆ ਗਿਆਰਵਾਂ ਲੱਗਾ ਤੇ ਹਾਂ ਨਹੀਂ ਵਧੀਆ ਹਾਂ ਵਧੀਆ ਚੱਲ ਰਿਹਾ ਦੇਖੋ ਸਕੂਲ ਤਾਂ ਸਾਰੇ ਈ ਵਧੀਆ ਹੁੰਦੇ ਆ ਹਨਾ ਤੇ ਮਤਲਬ ਜਿੱਥੇ ਟੀਚਰ ਸਹੀ ਆ ਤੇ ਉੱਥੇ ਸਕੂਲ ਸਾਰੇ ਈ ਸਹੀ ਆ ਵਿਦਿਆਰਥੀ ਸਹੀ ਹੋਣਾ ਚਾਹੀਦਾ ਪਰ ਜਿੱਥੋਂ ਤੱਕ ਹੈਗਾ ਕੀ ਨੰਬਰ ਵਨ ਟੂ ਜਿਹੜੇ ਚੱਲ ਰਹੇ ਨੇ ਉਹ ਹੈਗਾ ਡੀਪੀਐਸ ਹੈਗਾ ਪਹਿਲਾਂ ਨੰਬਰ ਤੇ ਤੇ ਇਹ ਆਪਣਾ ਤਲਵੰਡੀ ਰੋਡ ਵੱਲ ਈ ਪੈ ਜਾਂਦਾ ਠੀਕ ਆ ਤੇ ਫੇਰ ਦੁਲ ਬਾਬਾ ਫਰੀਦ ਜੀ ਆ ਜਾਂਦਾ ਬਾਬਾ ਫਰੀਦ ਪਬਲਿਕ ਸਕੂਲ ਫੇਰ ਆ ਜਾਂਦਾ ਉੱਥੇ ਇੱਕ ਹੋਰ ਹੈਗਾ ਉਹ ਨਾਂ ਭੁੱਲ ਜਾਨੀ ਆਂ ਤੇ ਚਲੋ ਪਰ ਮੈਨੂੰ ਜਿੱਥੋ ਤੱਕ ਮੈਨੂੰ ਆਪਣੀ ਬੱਚੇ ਦੀ ਤੱਕ ਪਤਾ ਲੱਗਦਾ ਕੀ ਉਹ ਕਿਵੇਂ ਚੱਲ ਰਿਹਾ ਹਨਾ ਦਸ ਸਾਲ ਦਾ ਚੌਥੀ ਕਲਾਸ ਚ ਹੋ ਗਿਆ ਇਸ ਟੈਮ ਹਨਾ ਤੇ ਕੀ ਆਪਣਾ ਵਧੀਆ ਚੱਲ ਰਿਹਾ ਟੀਚਰ ਸਵੀਟ ਸਹੀ ਐ ਤੇ ਬਾਕੀ ਇਹ ਆਪਣੇ ਨਾ ਹਾਂ ਸਾਰਾ ਕੁਛ ਆ ਸਾਰਾ ਕੁਛ ਹਾਂਜੀ ਕਿਉਂਕੀ ਜਿੱਥੋਂ ਤੱਕ ਮੈਨੂੰ ਸੀਗਾ ਕੀ ਪਲੇਅ ਵੇਅ 'ਚ ਮਤਲਬ ਜੋ ਇਹਨੂੰ ਸਿਖਾ ਰਹੇ ਸੀ ਮੈਨੂੰ ਪਹਿਲਾਂ ਇਹ ਸੀਗਾ ਕੀ ਇਹਨਾਂ ਦੀ ਇੰਟਰਵਿਊ ਹੁੰਦੀ ਐ ਪਹਿਲਾਂ ਤੇ ਵਧੀਆ ਤੁਸੀਂ ਪਹਿਲਾਂ ਜਾਨੀ ਕੀ ਉੱਥੇ ਲਾਇਆ ਹੋਇਆ ਗਾ ਤੇ ਉਹਦੇ ਕਰਕੇ ਮੈਂ ਤੁਹਾਨੂੰ ਸੌਖਾ ਹੋਜੂਗਾ ਕਿਉਂਕੀ ਮੈਨੂੰ ਨੀ ਪਤਾ ਸੀ ਮਤਲਬ ਹੁਣ ਪਤਾ ਲੱਗਣ ਲੱਗ ਪਿਆ ਕਿਉਂਕੀ ਮੈਂ ਤਾਂ ਤੁਹਾਨੂੰ ਇਹੀ ਗਾਈਡ ਕਰੂੰਗੀ ਕੀ ਡੀਪੀਐਸ ਸਹੀ ਆ ਤੇ ਇਹਦੇ ਵਿੱਚ ਇੰਟਰਵਿਊ ਹੋਊਈ ਤੇ ਪੌਣੇ ਤਿੰਨ ਸਾਲਾਂ ਦਾ ਲੈਣਾ ਇਹਨਾਂ ਨੇ ਕਿਉਂਕੀ ਮਈ ਵਿੱਚ ਦੋ ਕ ਦਿਨ ਦੋ ਕ ਮਹੀਨੇ ਹੋਰ ਉਹਨੂੰ ਰੈਸਟ ਕਰ ਲੈਣ ਦੇ ਸਾਰੀ ਉਮਰ ਪੜ੍ਹਨਾ ਈ ਆ ਹਨਾ ਤੇ ਮਤਲਬ ਹੁਣ ਉਹ ਜਾਨੀ ਕੀ ਇੰਟਰਵਿਊ ਲੈਣਗੇ ਫਿਰ ਤੁਹਾਡੀ ਜਾਨੀ ਕ ਉਹਨੇ ਵਿੱਚ ਉਹਨਾਂ ਨੇ ਨਾ ਪਲਾਸਟਿਕ ਦੇ ਖਲੋਣੇ ਰੱਖੇ ਹੁੰਦੇ ਆ ਹਨਾ ਜਾਂ ਕੋਈ ਬੁਕਸ ਵਗੈਰਾ ਪੜ੍ਹਾ ਕੇ ਦੇਖਣਗੇ ਜਿਵੇਂ ਏ ਫੋਰ ਐਪਲ ਵਾਲਾ ਉਹਦੇ ਵਿੱਚੋਂ ਵਿੱਚ ਉਹਨਾਂ ਨੇ ਪੁੱਛਣਾ ਜਿਹੜੀ ਕੀ ਜਿਹੜੀ ਇੰਟਰਵਿਊ ਪਾਸ ਹੋ ਗਿਆ ਮਤਲਬ ਇਨੀ ਫਿਰ ਉਹਦੀ ਉਹ ਹੋਜੂਗੀ ਤੇ ਫੀਸ ਜਰੂਰ ਜਿਆਦਾ ਆ ਫੀਸ ਵੈਗਰਾ

ਹਾਂ ਨਹੀਂ ਫੀਸ ਜਰੂਰ ਜਿਆਦਾ ਬਾਕੀ ਸਕੂਲਾਂ ਨਾਲੋਂ ਤੇ ਪਰ ਕੇਅਰ ਹੈਗੀ ਆ ਫੀਸ ਤਾਂ ਹੁਨ ਸੁੱਖ ਨਾਲ ਇਹਦੀ ਸਾਢੇ ਅਠਾਰਾਂ ਸੌ ਰੁਪਇਆ ਜਾਂਦਾ ਹੋਰ ਚਾਰ ਹਜ਼ਾਰ ਦੇ ਨੇੜੇ ਤੇੜੇ ਤੁਰ ਜਾਂਦਾ ਤੇ ਪਹਿਲਾਂ ਤੇਰਾ ਸ਼ੁਰੂਆਤ ਚ ਜਾਨੀ ਕੀ ਵੀਹ ਹਜ਼ਾਰ ਰੁਪਈਆ ਲੱਗੂਗਾ ਹੁਣ ਤਾਂ ਪਤਾ ਨੀ ਕਿੰਨਾ ਲੱਗੂਗਾ ਸ਼ਾਇਦ ਅਮਾਊਟ ਉਹਨਾਂ ਨੇ ਵਧਾ ਤੀ ਹੋਵੇ ਹਨਾ ਤੇ ਜਾਨੀ ਕੀ ਮੇਰਾ ਉਸ ਟੈਮ ਵੀਹ ਲੱਗਿਆ ਸੀ ਅੱਛਿਆ ਅੱਛਿਆ ਹਾਂ ਵਧੀਆ ਹਾਂ ਹਾਂ ਹਾਂ ਤੇ ਮੈਂ ਬਸ ਇਹੀ ਆ ਕੀ ਮੈਂ ਤਾਂ ਇਹ ਸੋਚਿਆ ਮੇਰੀਆਂ ਬੇਟੀਆਂ ਨੇ ਕਿਹਾ ਤਾਂ ਵੀ ਅਸੀਂ ਜਿਹੜੀ ਮਰਜੀ ਸਕੂਲ 'ਚ ਪੜ੍ਹ ਲਈਏ ਸਾਡਾ ਵੀਰਾ ਨੀ ਸਹੀ ਸਕੂਲ 'ਚ ਪੜ੍ਹਨਾ ਚਾਹੀਦਾ ਮਮਾ ਤੇ ਮੈਂ ਕਿਹਾ ਚਲ ਕੋਈ ਨੀ ਕੀ ਉਦੋਂ ਦਾ ਆਪਦੇ ਹਿਸਾਬ ਨਾਲ ਉਹੋ ਜਿਹਾ ਸੀਗਾ ਹੁਣ ਚੱਲ ਬੱਚੇ ਵਧੀਆ ਇੱਥੇ ਪੜ੍ਹਾਉਣਾ ਚਾਹੁੰਦੇ ਤੇ ਵਧੀਆ ਪੜ੍ਹਾ ਲਓ ਹਾਂ ਤੇ ਨਹੀਂ ਵਧੀਆ ਹੈਗਾ ਪਰ ਜਿਵੇਂ ਉੱਥੇ ਨਾ ਡੋਕਟਰਾਂ ਦੇ ਬੱਚੇ ਜਾਂ ਕੁਛ ਵੀ ਐ ਵਧੀਆ ਪੜ੍ਹਦੇ ਆ ਹਨਾ ਪੇਰੈਂਟਸ ਵਧੀਆ ਆਉਂਦੇ ਆ ਸਹੀ ਢੰਗ ਨਾਲ ਉਹਨਾਂ ਦੇ ਬੱਚੇ ਵੀ ਉੱਥੇ ਵਧੀਆ ਹੁੰਦੇ ਆ ਉਹ ਮਤਲਬ ਉਹਨਾਂ ਨੂੰ ਉਹ ਜਿਹੀ ਸੁਸਾਇਟੀ ਮਿਲਦੀ ਆ ਹਾਂ ਹਾਂ ਉਦਾਂ ਤਾਂ ਸਹੀ ਐ ਉੱਥੇ ਸਹੂਲਤਾਂ ਥੋੜੀ ਜਿਹੀਆਂ ਅੱਪ ਆਪ ਵੀ ਪੈ ਜਾਂਦੀਆਂ ਸਸਤਾ ਵੀ ਐ ਪਰ ਮੈਂ ਤਾਂ ਜਿੱਥੋਂ ਤੱਕ ਦੇਖਿਆ ਮੈਨੂੰ ਸਸਤੇ ਤੱਕ ਨਹੀਂ ਸੀ ਮੈਨੂੰ ਨਾ ਇਹ ਸੀਗਾ ਕੇ ਵੀ ਸਹੀ ਇਹਨੂੰ ਗਾਈਡ ਕਰਨ ਆਲੀਆਂ ਟੀਚਰਾਂ ਮਿਲਣ ਪਰ ਜਿੰਨੀਆਂ ਮਿਲੀਆਂ ਇਹਨੂੰ ਚਾਰ ਕਲਾਸਾਂ ਤੱਕ ਪੰਜ ਤੇ ਵਧੀਆ ਹਾਂ ਹੋਰ ਕੀ ਨਹੀਂ ਇਹ ਤਾਂ ਹੈਗਾ ਵੀ ਤਾਂ ਦੇਖੋ ਪਹਿਲਾਂ ਤਾਂ ਇਹਦੀ ਇੰਟਰਵਿਊ ਹੋਣੀ ਆ ਹਨਾ ਤੇ ਇੰਟਰਵਿਊ ਪਾਸ ਹੋਗੀ ਫਿਰ ਤੁਹਾਨੂੰ ਮੈਸੇਜ ਆ ਜਾਣਗੇ ਫੇਰ ਇਹਨਾਂ ਨੇ ਗਰੁੱਪ ਬਣਾ ਲੈਣਾ ਤੇ ਗਰੁੱਪ ਦੇ ਵਿੱਚ ਮਤਲਬ ਫੀਸ ਤੇ ਨਹੀਂ ਐ ਜਿਹੜੀ ਇਹਨਾਂ ਨੇ ਦੱਸ ਦੇਨੀ ਆ ਸਾਰੀ ਤੇ ਇੱਕ ਉਹਨਾਂ ਕੋਲੇ ਜਾਨੀ ਕੀ ਤਾਂ ਕੰਪਿਊਟਰ ਦੇ ਵਿੱਚ ਵੀ ਸਾਰਾ ਚੜ੍ਹ ਜਾਂਦਾ ਫਿਰ ਉੱਥੋਂ ਆਪਾਂ ਬੈਂਕ ਰਾਂਈ ਇਹਨਾਂ ਦੀ ਫੀਸ ਜਾਂਦੀ ਐ ਸਾਡੇ ਤਾਂ ਜਮ੍ਹਾਂ ਈ ਘਰ ਦੇ ਸਾਹਮਣੇ ਬੈਂਕ ਤੇ ਉਨਦੇ ਵਿੱਚ ਈ ਜਾਂਦੀ ਹਾਂ ਪਰ ਇਹਨਾਂ ਦਾ ਜਿਹੜਾ ਬੈਂਕ ਉਹ ਅਲੱਗ ਨਾਮ ਐ ਪਤਾ ਨੀ ਇਹਨਾਂ ਨੂੰ ਇਹ ਫੀਸ ਭਰ ਕੇ ਆਉਂਦੇ ਆ ਮੈਂ ਤਾਂ ਗਈ ਨੀ ਕਿਤੇ ਐਵੇਂ ਕਹੀਏ ਹਾਂ ਹਾਂ ਹਾਂ ਨਹੀਂ ਸਾਡੇ ਤਾਂ ਮੇਨ ਰੋਡ ਤੇ ਬੈਠੇ ਨਾ ਬੈਂਕ ਵੀ ਸਾਹਮਣੇ ਈ ਆ ਹਾਂ ਨਹੀਂ ਕੋਈ ਨੀ ਤੇ ਬਾਕੀ ਜੋ ਵੀ ਹੈਲਪ ਦੀ ਲੋੜ ਪਈ ਤੁਸੀਂ ਮੈਨੂੰ ਜਰੂਰ ਦੱਸ ਦਿਓ ਹਾਂ ਹਾਂ ਇਹ ਐ ਨਾ ਇੱਥੋਂ ਜੇ ਇੱਕ ਭੈਣ ਜਾਂ ਕੋਈ ਭਰਾ ਪੜ੍ਹਦਾ ਨਾ ਨਾਲ ਤਾਂ ਉਨਦੀ ਅੱਧੀ ਕੱਟੀ ਵੀ ਜਾਂਦੀ ਐ ਫੀਸ ਘੱਟ ਹੋ ਜਾਂਦੀ ਐ ਹਾਂ ਪਰ ਇਹ ਐ ਕੀ ਹੁਨ ਤੁਹਾਡਾ ਇਕੱਲਾ ਬੇਟਾ ਹਨਾ ਤੇ ਉਨਦੇ ਕਰਕੇ ਮੁਸ਼ਕਿਲ ਜਾ ਆਜੂਗਾ ਸਾਨੂੰ ਫੇਰ ਥੋੜਾ ਫਰਕ ਪੈ ਗਿਆ ਸੀ ਜਦੋਂ ਮੇਰੀ ਬੇਟੀ ਸੀਗੀ ਨਾਲ ਹਾਂ ਹਾਂ ਉਨਦੇ ਨਾਲ ਤਾਂ ਹੁਣ ਉਹ ਵੱਡੀ ਨਾਲੋਂ ਸਤਾਰਾਂ ਸਾਲਾਂ ਦਾ ਫਰਕ ਐ ਇਹਦਾ ਛੇ ਸੱਤ ਸਾਲਾਂ ਤੋਂ ਜਿਆਦਾ ਹੋਜੇਗਾ ਥੋੜਾ ਜਿਹਾ ਤੇ ਉਹਨੇ ਕਰਕੇ ਫਿਰ ਮੈਨੂੰ ਫੀਸ ਦਾਂ ਤਾਂ ਕੋਈ ਚੱਕਰ ਨੀ ਮੈਂ ਕਿਹਾ ਬਸ ਜੁਆਕ ਪੜ੍ਹ ਲੈਣ ਹਾਂ ਨਹੀਂ ਤੁਸੀਂ ਮੈਨੂੰ ਦੱਸਿਓ ਕੋਈ ਨੀ ਆਪਾਂ ਕਰ ਲਾਂਗੇ ਕੋਈ ਇਹਨਾਂ ਨੂੰ ਜਾਣਦਾ ਹੋਊਗਾ ਸ਼ਾਇਦ ਕਿਉਂਕੀ ਹੁਨ ਪੁਰਾਣੇ ਜਿਵੇਂ ਆਪਾਂ ਲੱਗੇ ਹੋਈਏ ਹਨਾ ਬੱਚੇ ਲਾਏ ਹੋਈਏ ਤੇ ਨੋਲੇਜ ਵੀ ਹੋ ਜਾਂਦੀ ਕੁਛ ਪਤਾ ਲੱਗ ਜਾਂਦਾ ਫਰੈਂਡ ਵੀ ਬਨ ਜਾਂਦੇ ਹਾਂਜੀ ਹਾਂਜੀ ਹੋਰ ਕੋਈ ਨਹੀਂ ਹਾਂਜੀ ਠੀਕ ਐ ਜੀ ਠੀਕ ਐ ਸਸਰੀ ਕਾਲ